ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਸਰ ਮੈਂ ਨਾ ਇੱਥੋਂ ਹੰਡਿਆਏ ਤੋਂ ਬੋਲਦਾ ਸੀਗਾ ਜੀ ਸਰ ਮੈਨੂੰ ਕੁਛ ਕੁ ਨਾਵਲ ਚਾਹੀਦੇ ਸੀਗੇ ਅਤੇ ਨਾਵ ਹਾਂਜੀ ਨਾਵਲ ਸਰ ਮੜੀ ਦਾ ਦੀਵਾ ਹੋ ਗਿਆ ਰਾਣੀ ਤੱਤ ਰਾਣੀ ਤੱਤ ਹਾਂਜੀ ਇਹ ਮੋਹਨ ਸਿੰਘ ਦਾ ਇਹੋ ਹਮਾਰਾ ਜੀਵਣਾ ਹਾਂਜੀ ਹਾਂਜੀ ਮੈਨੂੰ ਕਾਫੀ ਨਾਵਲ ਚਾਹੀਦੇ ਸੀਗੇ ਵੀ ਮੈਨੂੰ ਦੱਸਿਆ ਸੀਗਾ ਵੀ ਤੁਹਾਡੀ ਦੁਕਾਨ ਤੋਂ ਵੀ ਪੁੱਛਣ ਦੀ ਲੋੜ ਨਹੀਂ ਕਹਿੰਦੀ ਵੀ ਹਰ ਤਰ੍ਹਾਂ ਦੇ ਹੀ ਮਿਲ ਜਾਂਦੇ ਹੈਗੇ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਖੁਸ਼ਵੰਤ ਸਿੰਘ ਵਗੈਰਾ ਦੇ ਦਿਉਂਗੇ ਦਵਿੰਦਰ ਵਿਦਿਆਰਥੀ ਸਾਰਿਆਂ ਦੇ ਮਿਲ ਜਾਂਦੇ ਜੀ

ਹਾਂਜੀ ਇੱਕ ਨਾ ਮੇਰਾ ਬੱਚਾ ਹੈਗਾ ਜੀ ਹੈਗਾ ਦਸ ਕੁ ਸਾਲ ਦਾ ਹੈਗਾ ਉਹਦੇ ਵਾਸਤੇ ਵੀ ਮੈਨੂੰ ਐਂ ਵੀ ਕਹਾਣੀ ਵਾਲੀਆਂ ਕੋਈ ਸੇ ਸੇਧ ਦੇਣ ਵਾਲੀਆਂ ਉਹਦੇ ਜੀਵਨ ਦੇ ਵਿੱਚ

ਅੱਛਾ ਜੀ

ਔਰ ਉਹ ਬਸ ਆਂਈਂ ਆ ਜੀ ਉਹ ਮੋਬਾਇਲ ਤੋਂ ਉਹਦਾ ਖਹਿੜਾ ਛੁੱਟਜੇ ਵੀ ਕਹਾਣੀਆਂ ਕਹੂਣੀਆਂ ਪੜ੍ਹਨ ਲੱਗਜੇ ਕਿਤਾਬਾਂ ਪੜ੍ਹਨਾ ਤਾਂ ਵਧੀਆ ਹੁੰਦਾ ਹੈਗਾ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਨਾ ਇੱਕ ਮੈਂ ਹੋਰ ਪੁੱਛਦਾ ਸੀ ਕਿਵੇਂ ਸਾਡੇ ਮਾਤਾ ਜੀ ਹੋਰਾਂ ਨੇ ਗੀਤਾ ਦਾ ਪਾਠ ਕਰਦੇ ਹੁੰਦੇ ਹੈਗੇ ਉਹ ਕਹਿੰਦੇ ਗੀਤਾ ਦਾ ਮੈਂ ਕਿਹਾ ਬੀ ਪੁੱਛ ਤਾਂ ਲੈਂਦਾ ਬੀ ਜਾਊਗਾ ਤਾਂ ਸਹੀ ਹਾਂਜੀ ਅੱਛਾ ਜੀ

ਠੀਕ ਹੈ ਠੀਕ ਹੈ ਤ ਠੀਕ ਹੈ ਜੀ ਜਿਹੜੇ ਵਰਤਾਂ ਵੁਰਤਾਂ ਵਾਲੀਆਂ ਕਥਾ ਕਹਾਣੀਆਂ ਸੋਮਵਾਰ ਮੰਗਲਵਾਰ ਵਾਲਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਹਾਂ ਚਲ ਇਹਨਾਂ ਸਾਰੀਆਂ ਬੁੱਕਸ ਦਾ ਕਿਵੇਂ ਕੋਈ ਲੈਸ ਵਗੈਰਾ ਵੀ ਹੋਊਗਾ ਜੇ ਮੈਂ ਇੰਨੀਆਂ ਖਰੀਦੂੰਗਾ ਤੁਹਾਡੇ ਕੋਲੋਂ ਅੱਛਾ ਠੀਕ ਹੈ ਜੀ

ਠੀਕ ਹੈ ਸਰ ਹਾਂਜੀ ਹਾਂਜੀ ਓਕੇ ਸਰ ਥੈਂਕ ਯੂ ਜੀ ਹਾਂਜੀ ਥੈਂਕ ਯੂ ਸਰ ਮੈਂ ਕੱਲ੍ਹ ਨੂੰ ਆਊਂਗਾ ਜੀ ਓਕੇ ਓਕੇ